ਤੁਹਾਡੇ ਪਿੰਡ ਦੇ ਲੋਕ ਆਪਣੇ ਬੱਚਿਆਂ ਨੂੰ ਪੋਲੀਓ ਤੋਂ ਬਚਾਉਣ ਲਈ ਕੀ ਕਰਦੇ ਹਨ ਸਾਡੇ ਪਿੰਡ ਦੇ ਲੋਕ ਆਪਣੇ ਬੱਚਿਆਂ ਨੂੰ ਪੋਲੀਓ ਤੋਂ ਬਚਾਉਣ ਲਈ ਇੰਜੈਕਸ਼ਨ ਲਗਵਾਉਂਦੇ ਹਨ ਇੰਜੈਕਸ਼ਨ ਲਗਵਾਉਂਦੇ ਹਨ ਅਤੇ ਪੋਲ ਅਪਾਹਿਜ ਹੋਣ ਤੋਂ ਬੱਚਿਆਂ ਨੂੰ ਬਚਾਉਂਦੇ ਹਨ ਜਦੋਂ ਬੱਚਾ ਅਪਾਹਿਜ ਹੋ ਜਾਵੇ ਤਾਂ ਮਾਂ ਪਿਓ ਨੂੰ ਵੀ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਬੱਚਿਆਂ ਲਈ ਤਾਂ ਬਹੁਤ ਮੁਸ਼ਕਲ ਹੀ ਹੁੰਦੀ ਆ ਪਰ ਮਾਂ ਪਿਓ ਲਈ ਵੀ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਇਸ ਲਈ ਪੋਲੀਓ ਦਾ ਟੀਕਾ ਲਗਵਾਉਣ ਲਈ ਹੋਸਪੀਟਲ ਜਾਇਆ ਜਾਂਦਾ ਹੈ ਅਤੇ ਬੱਚਿਆਂ ਨੂੰ ਪੋਲੀਓ ਤੋਂ ਬਚਾਉਣ ਲਈ ਪੋਲੀਓ ਦਾ ਟੀਕਾ ਲਗਵਾਇਆ ਜਾਂਦਾ ਹੈ ਅਤੇ ਬੱਚਿਆਂ ਨੂੰ ਪੋਲੀਓ ਜਾ ਟੀਕਾ ਲਗਾਉਣਾ ਬਹੁਤ ਹੀ ਜ਼ਰੂਰੀ ਹੈ ਦੇਸ਼ ਦਾ ਭਵਿੱਖ ਨਹੀਂ ਤਾਂ ਬਹੁਤ ਜ਼ਿਆਦਾ ਖਰਾਬ ਹੋ ਜਾਵੇਗਾ ਅਗਰ ਬੱਚੇ ਪੋਲੀਓ ਦੇ ਮਰੀਜ਼ ਹੋ ਕੇ ਆਪਣੇ ਅੰਗ ਖਰਾਬ ਕਰ ਲੈਣਗੇ ਇਸ ਲਈ ਪਰਿਵਾਰ ਨੂੰ ਵੀ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ